ਹੈਲੋ ਮੀਸ਼ੋ ਤੋਂ ਬੋਲਦੇ ਪਏ ਭਾਅ ਜੀ ਭਾਅ ਜੀ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਸੀ ਮੈਂ ਤੁਹਾਡੇ ਤੋਂ ਪਰਸ ਖਰੀਦਿਆ ਸੀ ਜੋ ਕਿ ਬੜਾ ਹੀ ਸੋਹਣਾ ਬਣਿਆ ਹੋਇਆ ਸੀ ਇਸ 'ਤੇ ਲੱਗਾ ਹੋਇਆ ਕੱਪੜਾ ਬੜਾ ਹੀ ਮਜ਼ਬੂਤ ਸੀ ਇਸ ਦਾ ਰੰਗ ਇੰਨਾ ਸੋਹਣਾ ਸੀ ਕਿ ਸਾਰਿਆਂ ਨੂੰ ਬੜਾ ਹੀ ਪਸੰਦ ਆਇਆ ਮੈਂ ਇਹ ਪਰਸ ਵਿਆਹ 'ਤੇ ਲੈ ਕੇ ਗਈ ਸੀ ਸਾਰੇ ਹੀ ਮੈਨੂੰ ਪੁੱਛ ਰਹੇ ਸੀ ਕਿ ਤੁਸੀਂ ਇਹ ਪਰਸ ਕਿੱਥੋਂ ਖਰੀਦਿਆ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਪਰਸ ਮੈਂ ਮੀਸ਼ੋ ਤੋਂ ਔਨਲਾਈਨ ਮੰਗਵਾਇਆ ਹੈ ਇਸ ਦਾ ਰੰਗ ਮੈਨੂੰ ਮਾਰਕੀਟ ਵਿੱਚੋਂ ਕਿਤਿਓਂ ਨਹੀਂ ਸੀ ਲੱਭਦਾ ਜੋ ਕਿ ਮੀਸ਼ੋ ਤੋਂ ਲੱਭ ਗਿਆ ਮੀਸ਼ੋ ਤੋਂ ਇਹ ਪਰਸ ਮੈਨੂੰ ਬੜਾ ਹੀ ਸੋਹਣਾ ਮਿਲਿਆ ਹੋਇਆ ਹੈ ਇਸ 'ਤੇ ਲੱਗੇ ਹੋਏ ਸਟੋਨ ਬੜੇ ਹੀ ਸੋਹਣੇ ਅਤੇ ਚਮਕਦਾਰ ਹਨ ਇਸ ਦੀਆਂ ਦੋ ਤਣੀਆਂ ਬਣੀਆਂ ਹੋਈਆਂ ਨੇ ਇੱਕ ਆਪਾਂ ਹੱਥ ਵਿੱਚ ਫੜ ਸਕਦੇ ਹਾਂ ਅਤੇ ਦੂਜੀ ਆਪਾਂ ਮੋਢੇ 'ਤੇ ਵੀ ਪਾ ਸਕਦੇ ਹਾਂ ਇਸ ਦੀ ਕੀਮਤ ਬੜੀ ਹੀ ਘੱਟ ਹੈ ਬਾਜ਼ਾਰ ਨਾਲੋਂ ਇਹ ਕੀਮਤ ਬਹੁਤ ਹੀ ਘੱਟ ਹੈ ਇਸ ਦੀ ਬਣਤਰ ਇੰਨੀ ਸੋਹਣੀ ਬਣੀ ਹੋਈ ਹੈ ਇਸ ਦੀਆਂ ਤਿੰਨ ਜੇਬਾਂ ਹਨ ਪਰਸ ਖੁੱਲ੍ਹਾ ਡੁੱਲ੍ਹਾ ਬਣਿਆ ਹੋਇਆ ਹੈ ਇਸ ਵਿੱਚ ਮੈਂ ਆਪਣਾ ਕੋਈ ਵੀ ਸਮਾਨ ਖੁੱਲ੍ਹਾ ਡੁੱਲ੍ਹਾ ਪਾ ਸਕਦੀ ਹਾਂ